ਗੱਤਕਾ ਸਿੱਖਣ ਦਾ ਮੂਲ ਅਰਥ ਇਹ ਹੈ ਕਿ ਗੱਤਕਾ ਯੁੱਧ ਵਿੱਚ ਅਪਣਾਇਆ ਜਾ ਸਕਦਾ ਹੈ ਆਪਣੇ ਸ ਆਤਮ ਰੱਖਿਆ ਵਾਸਤੇ ਸਿੱਖਿਆ ਜਾ ਸਕਦਾ ਹੈ ਅਤੇ ਇਸਦਾ ਇਤਿਹਾਸ ਸਿੰਘਾਂ ਨਾਲ ਜੁੜਿਆ ਹੋਇਆ ਜਦੋਂ ਵੀ ਸਿੰਘਾਂ ਨੂੰ ਜੰਗਾਂ ਲੜਨੀਆਂ ਹੁੰਦੀਆਂ ਤਾਂ ਉਹਨਾਂ ਨੂੰ ਅਭਿਆਸ ਸ਼ਸਤਰਾਂ ਦਾ ਹੋਣਾ ਚਾਹੀਦਾ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਫੌਜਾਂ ਨੂੰ ਗੱਤਕਾ ਸਿਖਾਉਣ ਦੀ ਪਹਿਲ ਕੀਤੀ